ਜਦੋਂ ਵੀ ਅਸੀਂ ਕਿਤੇ ਇੱਧਰ ਉੱਧਰ ਜਾਈ ਦਾ ਚਾਹੇ ਪਿੰਡ ਦੇ ਵਿੱਚ ਜਾਣਾ ਚਾਹੇ ਆਪਣਾ ਸ਼ਹਿਰ ਦੇ ਵਿੱਚ ਜਾਣਾ ਅਤੇ ਰਸਤੇ ਦੇ ਵਿੱਚ ਕੋਈ ਜਦ ਡਿਸਪੈਂਸਰੀ ਆਪਣਾ ਮਿਲਦੀ ਹੈ ਨਰਸਰੀ ਸੋਰੀ ਡਿਸਪੈਂਸਰੀ ਨਰਸਰੀ ਨਰਸਰੀ ਮਿਲਦੀ ਹੈ ਉੱਥੇ ਜਿਹੜਾ ਆਪਣੇ ਕੋਈ ਬੂਟਾ ਪਸੰਦ ਆ ਜਾਂਦਾ ਉਹਨੂੰ ਲੈ ਆਈ ਦਾ ਨਹੀਂ ਫਿਰ ਸ਼ਹਿਰਾਂ ਦੇ ਵਿੱਚ ਤਾਂ ਆਮ ਕਰਕੇ ਹਰੇਕ ਦੋ ਜਾਂ ਤਿੰਨ ਕਿਲੋਮੀਟਰ ਦੇ ਵਿੱਚ ਨਰਸਰੀ ਮਿਲ ਜਾਂਦੀ ਹੈ ਉੱਥੋਂ ਬੂਟਾ ਲੈ ਆਈ ਦਾ ਅਤੇ ਆਪਣੇ ਬਗੀਚੇ ਵਿੱਚ ਲਾਉਣ ਖ਼ਾਤਰ ਉਹਦੇ ਖ਼ਾਤਰ ਮਿੱਟੀ ਬਹੁਤ ਜ਼ਰੂਰੀ ਹੈ ਮਿੱਟੀ ਦੇ ਨਾਲ਼ ਦੇਸੀ ਖਾਦ ਜਿਹਨੂੰ ਆਪਾਂ ਢੇਰ ਵਾਲੀ ਖਾਦ ਕਹਿੰਦੇ ਹਾਂ ਉਹ ਬਹੁਤ ਜ਼ਰੂਰੀ ਹੈ ਕਿਉਂ ਜੇ ਆਪਾਂ ਯੂਰੀਆ ਵਗੈਰਾ ਜਾਂ ਕੋਈ ਹੋਰ ਆਪਣਾ ਵਰਤੂੰਗੇ ਉਹਦੇ ਨਾਲ਼ ਇਨ੍ਹਾਂ ਨਵੇਂ ਬੂਟਿਆਂ ਨੂੰ ਥੋੜ੍ਹਾ ਜਿਹਾ ਅਸਰ ਪੈਂਦਾ ਬਾਕੀ ਇਹਨਾਂ ਦੀ ਸਾਂਭ ਸੰਭਾਲ ਖ਼ਾਤਰ ਇੱਕ ਘੰਟਾ ਰੋਜ਼ ਦੀ ਰੋਜ਼ ਇੱਕ ਜ਼ਰੂਰ ਕੱਢਣਾ ਚਾਹੀਦਾ ਹੈ ਇੱਕ ਘੰਟਾ ਇਹਦੇ ਵਿੱਚ ਕੋਈ ਦੇਖਣਾ ਏ ਕੋਈ ਇਹਦੇ ਵਿੱਚ ਜੀਵ ਜੰਤੂ ਛੋ ਛੋਟਾ ਜਾਨਵਰ ਸੁੰਡੀ ਵਗੈਰਾ ਨਾ ਹੋਵੇ ਜਾਂ ਕੋਈ ਕੋਈ ਚ ਤੁਰਿਆ ਜਾਂਦਾ ਕੁੱਤਾ ਨਾ ਇਹਦਾ ਕੋਈ ਨੁਕਸਾਨ ਕਰ ਦੇਵੇ ਜਿਵੇਂ ਚਰਖਾਰੀ ਸਾਨ ਤੁਰੀ ਫਿਰਦੇ ਹੈ ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਬਾਕੀ ਜੇ ਕਿਤੇ ਇਹਨੂੰ ਕੁਛ ਵੀ ਚੀਜ਼ ਦੀ ਜ਼ਰੂਰਤ ਹੈ ਬੇਸ਼ੱਕ ਭਾਵੇਂ ਸਪਰੇਅ ਕਰਨੀ ਹੈ ਭਾਵੇਂ ਇਹਨੂੰ ਕੋਈ ਹੋਰ ਆਪਣਾ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਸਵਾਹ ਜਿਹੜੀ ਹੁੰਦੀ ਸੀ ਚੁੱਲ੍ਹਿਆਂ ਵਾਲੀ ਉਹਦੇ ਨਾਲ਼ ਬਹੁਤ ਤ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਤਾਂ ਹੁਣ ਅੱਜ ਕੱਲ੍ਹ ਸਵਾਹ ਤਾਂ ਪਿੰਡਾਂ 'ਚ ਵੀ ਨਹੀਂ ਮਿਲਦੀ ਸ਼ਹਿਰ 'ਚ ਤਾਂ ਕੀ ਮਿਲਣੀ ਹੈ ਇਹਦੇ ਕਰਕੇ ਜਿੱਥੇ ਇਹਦੀ ਜਗ੍ਹਾ ਮਿਲਦੀ ਹੈ ਬੂਟੇ ਦੀ ਉੱਥੇ ਬੂਟਾ ਲਾ ਦਈਦਾ ਅਤੇ ਬਗ਼ੀਚਾ ਜਿਹੜਾ ਹਰਾ ਭਰਾ ਰਹਿੰਦਾ